ਹੈਲੋ ਹਾਂਜੀ ਬਾਈ ਸਾਹਿਬ ਮੈਂ ਵੀ ਤੁਹਾਨੂੰ ਇਹੀ ਕਹਿਣਾ ਸੀਗਾ ਬੜਾ ਟਾਈਮ ਹੋ ਗਿਆ ਆਪਾਂ ਮਿਲੇ ਨਹੀਂ ਗੱਲ ਨਹੀਂ ਕੀਤੀ ਮੇਰਾ ਵੀ ਕੰਮ ਬਸ ਠੀਕ ਠਾਕ ਜਿਹਾ ਏ ਟਾਇਮ ਪਾਸ ਹੁੰਦਾ ਪਿਆ ਏ ਅਤੇ ਹਾਂ ਹਾਂ ਹਾਂ ਜਿਹੜਾ ਜਿਹੜਾ ਸਸਤਾ ਏ ਬਸ ਉਹਨੂੰ ਮੰਗਦੇ ਨੇ ਅਤੇ ਉਹ ਵੀ ਆਪਣਾ ਕਿੰਨਾ ਕੁ ਪੂਰਾ ਨਹੀਂ ਹੁੰਦਾ ਅਤੇ ਉਹਦੇ 'ਚ ਵੀ ਆਪਾਂ ਨੂੰ ਉਲਾਂਭਾ ਹੀ ਰਹਿੰਦਾ ਬਈ ਅੱਜ ਆਹ ਖ਼ਰਾਬ ਨਿਕਲ ਗਏ ਤਾਂ ਅੱਜ ਆ ਖ਼ਰਾਬ ਨਿਕਲ ਗਿਆ ਹੈ ਨਾ ਅਤੇ ਸੇਬ ਹੀ ਵਿਕਦਾ ਪਿਆ ਮੇਰੇ ਕੋਲ ਤਾਂ ਅੱਜ ਕੱਲ੍ਹ ਜ਼ਿਆਦਾ ਅਤੇ ਹਾਂ

ਹਾਂ ਭਾਈ ਸਾਹਿਬ ਤੁਸੀਂ ਇਹ ਖਜੂਰ ਵੀ ਲਿਆਂਦੇ ਹੋ ਮੈਂ ਖਜੂਰ ਲਿਆਂਦੀ ਸੀ ਮੇਰੀ ਤਾਂ ਇੰਨੀ ਵਿਕੀ ਨਹੀਂ ਅਤੇ ਖਜੂਰ ਦੀ ਸੇਲ ਕਿਵੇਂ ਆਪਣੇ ਕੋਲ ਅੱਜ ਕੱਲ੍ਹ

ਅੱਛਾ ਅੱਛਾ ਹਾਂ ਹਾਂ ਹਾਂ ਫਿਰ ਆਪਣਾ ਨਾ ਮੇਨ ਅੱਡੇ ਦੇ ਹੈਗਾ ਇੱਥੇ ਚੰਗੇ ਘਰ ਲੱਗੇ ਹੋਏ ਨੇ ਅਤੇ ਆਪਾਂ ਨੂੰ ਹੁੰਦਾ ਕਿ ਚਲੋ ਵਧੀਆ ਵਾਲੀ ਲਿਆਈਏ ਪਰ ਨਾ ਮੰਦਾਂ ਹੀ ਨਿਕਲਦਾ ਗਲਤ ਚੱਲਦਾ ਫੇਰ ਉਹ ਚੰਗੇ ਘਰ ਵੀ ਮੈਨੂੰ ਲੱਗਦਾ ਫਰੂਟ ਨਹੀ ਪ੍ਰੋਪਰ ਲੈਂਦੇ ਪਏ ਆਪਣੇ ਕੋਲ ਅੱਜ ਕੱਲ੍ਹ ਅਤੇ ਹੁਣ ਦੇਖੋ ਜਿਵੇਂ ਮੈਂ ਅੱਜ ਕੱਲ੍ਹ ਮੈਨੂੰ ਡਿਮਾਂਡ ਸੀਗੀ ਕਿ ਉਹ ਲੈ ਕੇ ਆਓ ਚੰਗਾ ਵਧੀਆ ਕੀਵੀ ਲੈ ਕੇ ਆਓ ਕਿਉਂਕਿ ਅੱਜ ਕੱਲ੍ਹ ਉਹ ਚੱਲ ਪਿਆ ਡੇਂਗੂ ਅਤੇ ਪਰ ਕੀਵੀ ਦੀ ਸੇਲ ਵੀ ਨਹੀਂ ਨਿਕਲੀ ਅਤੇ ਮੇਰੀ ਕੀਵੀ ਵੀ ਦੇਖੋ ਹੁਣ ਸਰਦੀ 'ਚ ਇੰਨੀ ਮਹਿੰਗੀ ਕੀਵੀ ਮੈਂ ਲੈ ਤਾ ਆਇਆ ਅਤੇ ਪਰ ਨਾ ਉਹ ਜਿਵੇਂ ਖੱਟੀ ਹੋਣ ਕਰਕੇ ਉਹ ਵੀ ਨਹੀਂ ਵਿਕ ਰਹੀ ਅਤੇ ਤੁਸੀਂ ਫੇਰ ਹੁਣ ਹਾਂਜੀ ਅਤੇ ਨਹੀਂ ਗਰਮੀਆਂ 'ਚ ਵੀ ਗਰਮੀਆਂ ਚ ਵੀ ਇਹੀ ਕੁਛ ਰਹਿੰਦਾ ਆਪਣੇ ਨਾਲ ਕਦੇ ਉਹ ਫਰੂਟ ਥੋੜ੍ਹਾ ਬਹੁਤਾ ਖ਼ਰਾਬ ਹੋ ਜਾਂਦਾ ਅਤੇ ਉਹ ਆਪਣੇ ਖਾਤੇ 'ਤੇ ਚਲਾ ਜਾਂਦਾ ਹੈ ਨਾ ਅਤੇ ਅੱਛਾ ਅੱਛਾ ਅਤੇ

ਹਾਂ ਨਹੀਂ ਨਹੀਂ ਤੁਸੀਂ ਇਸ ਤੋਂ ਇਲਾਵਾ ਹੋਰ ਕੀ ਲਿਆ ਰਹੇ ਹੋ ਫਰੂਟ ਵਗੈਰਾ ਵੀ ਅਮਰੂਦ ਬੜਾ ਸੋਹਣਾ

ਅੱਛਾ ਅਤੇ ਫੇਰ ਤੁਸੀਂ ਅੱਜ ਕੱਲ੍ਹ ਦੁਕਾਨ 'ਤੇ ਇਕੱਲੇ ਰਹਿੰਦੇ ਪਏ ਹੋ ਕਿ ਰੱਖਿਆ ਹੋਇਆ ਮੁੰਡਾ ਫੇਰ ਅੱਛਾ ਅੱਛਾ ਅੱਛਾ ਅਤੇ ਫਿਰ ਵਿੱਚੋਂ ਤੁਹਾਨੂੰ ਉਹਦਾ ਟਾਈਮ ਮਿਲ ਜਾਂਦਾ ਘਰ ਵਾਸਤੇ ਅਤੇ ਅੱਛਾ ਅੱਛਾ ਚਲੋ ਕੋਈ ਨਹੀਂ ਠੀਕ ਹੈ ਬਸ ਫਿਰ ਆਪਾਂ ਕਰਦੇ ਹਾਂ ਗੱਲ ਫਿਰ ਦੁਬਾਰਾ ਠੀਕ ਹੈ ਬਾਈ ਸਾਹਿਬ ਹਾਂਜੀ ਹਾਂਜੀ ਠੀਕ ਹੈ ਭਾਈ ਸਾਹਿਬ